ਮੈਂ ਆਪਣੀ ਜਿੰਦਗੀ ਵਿੱਚ ਬਹੁਤ ਸਾਰੀ ਫੋਟੋ ਖਿੱਚੀਆਂ ਹਨ ਮੈਂ ਬਚਪਨ ਤੋਂ ਹੀ ਫੋਟੋ ਖਿੱਚਣ ਲੱਗ ਗਿਆ ਸੀ ਸਭ ਤੋਂ ਪਹਿਲਾਂ ਮੈਂ ਘੰਟਾ ਘਰ ਦੀ ਫੋਟੋ ਖਿੱਚੀ ਸੀ ਜਿਹੜੀ ਕਿ ਉਸ ਟਾਈਮ ਮੇਰੀ ਉਮਰ ਪੰਦਰਾਂ ਸਾਲ ਸੀ